ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਅਖਬਾਰ ਏਜੰਸੀਆਂ ਹੋ ਗਈਆਂ ਔਨਲਾਈਨ ਨਿਊਜ਼ ਨਿਊਜ਼ ਪਲੇਟਫਾਰਮ ਹੋ ਗਏ ਵੀ ਇਹ ਨਾ ਬਲੋਗਾਂ ਨਾਲ ਜਾਂ ਪੋਸਟਾਂ ਨਾਲ ਕਿਵੇਂ ਜੁੜੇ ਰਹਿਦੇ ਨੇ ਇਹਦਾ ਸਭ ਤੋਂ ਮੇਨ ਕਾਰਨ ਹੈਗਾ ਇੱਕ ਜੁੜਨ ਦਾ ਇੰਟਰਨੈਟ ਇੰਟਰਨੈਟ ਕੀ ਹੈ ਅੱਜ ਦੇ ਜ਼ਮਾਨੇ 'ਚ ਆਪਾਂ ਇੱਕ ਕੋਨੇ ਤੋਂ ਬਹਿ ਕੇ ਦੂਜੇ ਕੋਨੇ ਤੱਕ ਕਿਸੇ ਨਾਲ ਵੀ ਕੋਈ ਗੱਲਬਾਤ ਕਰ ਸਕਦੇ ਹਾਂ ਕਿਸੇ ਨੂੰ ਆਪਾਂ ਕੁਛ ਭੇਜ ਸਕਦੇ ਹਾਂ ਕਿਸੇ ਨਾਲ ਅਸੀਂ ਵੀਡੀਓ ਕਾਲ ਕਰ ਸਕਦੇ ਹਾਂ ਕਿਸੇ ਨਾਲ ਕੋਈ ਅਸੀਂ ਮੀਟਿੰਗ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਅੱਜ ਕੱਲ੍ਹ ਇੱਕ ਬੰਦਾ ਦੂਜੇ ਬੰਦੇ ਨਾਲ ਕਿਤੇ ਵੀ ਬੈਠੇ ਅਤੇ ਦੁਨੀਆਂ ਦੇ ਇੱਕ ਕੋਨੇ ਤੋਂ ਬਹਿ ਕੇ ਦੂਜੇ ਕੋਨੇ ਤੱਕ ਕੁਨੈਕਟ ਕਰ ਸਕਦਾ ਹੈ ਐਵੇਂ ਹੀ ਜਿਹੜੀਆਂ ਅਖਬਾਰ ਏਜੰਸੀਆਂ ਨੇ ਨਿਊਜ਼ ਪਲੇਟਫਾਰਮ ਨੇ ਇਹ ਇੰਟਰਨੈਟ ਦੇ ਥਰੂ ਇੱਕ ਦੂਜੇ ਦੇ ਪਲੇਟਫਾਰਮਾਂ ਨਾਲ ਜੁੜੇ ਹੁੰਦੇ ਜਿਵੇਂ ਨਿਊਜ਼ ਏਜੰਸੀਆਂ ਅਲੱਗ ਅਲੱਗ ਕੰਪਨੀਆਂ ਦੇ ਨਾਲ ਇੱਕ ਇੱਕ ਫਰਮ ਤੋਂ ਦੂਜੀ ਫਰਮ ਦੇ ਨਾਲ ਇਹਨਾਂ ਦੇ ਲਿੰਕ ਹੁੰਦੇ ਹੈ ਅਤੇ ਇਹਨਾਂ ਦੇ ਅਲੱਗ ਅਲੱਗ ਬਰਾਂਚਾਂ ਬਣੀਆਂ ਹੋਈਆਂ ਅਲੱਗ ਅਲੱਗ ਡਿਸਟਿਕਾਂ ਦੇ ਵਿੱਚ ਜੋ ਕੋਈ ਵੀ ਨਵਾਂ ਆਰਟੀਕਲ ਕਵਰ ਕਰਨਾ ਕੋਈ ਵੀ ਨਵੀਂ ਖੋਜ ਹੁੰਦੀ ਹੈ ਉਹਨੂੰ ਕਵਰ ਕਰਨਾ ਉਸਨੂੰ ਕਵਰ ਕਰਨ ਦੇ ਲਈ ਇਹਨਾਂ ਇਹ ਏਜੰਸੀਆਂ ਕੰਮ ਕਰਦੀਆਂ ਹਨ